ਕੋਈ ਵੀ ਦਸਤਾਵੇਜ਼ ਬਣਾਉਣਾ ਹੈ ਇਹਦੇ ਵਿੱਚ ਥੋੜ੍ਹੀ ਜਿਹੀ ਮੁਸ਼ਕਿਲ ਤਾਂ ਆਉਂਦੀ ਹੈ ਪਰ ਬਣ ਜਾਂਦਾ ਜਿਵੇਂ ਕਿਤੇ ਆਪਾਂ ਨੇ ਪਾਸਪੋਰਟ ਬਣਾਉਣਾ ਪਹਿਲੇ ਪਾਸਪੋਰਟ ਐਪਲਾਈ ਕਰਨਾ ਹੈ ਅਤੇ ਸਾਨੂੰ ਡੇਟ ਮਿਲਦੀ ਹੈ ਪਾਸਪੋਰਟ ਦਫਤਰ ਦੇ ਵਿੱਚ ਜਾਣ ਦੀ ਉੱਥੇ ਫੇਰ ਸਾਡੀ ਇੰਟਰਵਿਊ ਲੈਂਦੇ ਹੈ ਇੰਟਰਵਿਊ ਲੈਣ ਤੋਂ ਬਾਅਦ ਫਿਰ ਉਹ ਵੈਰੀਫਿਕੇਸ਼ਨ ਲਈ ਭੇਜਦੇ ਹੈ ਮੌਜੂਦਾ ਜੋ ਇਲਾਕੇ ਦਾ ਐਸ ਐਸ ਪੀ ਹੁੰਦਾ ਉਹ ਐਸ ਐਸ ਪੀ ਹੈ ਜਿਹੜਾ ਉਹ ਇਲਾਕੇ ਕੰਸਰਨ ਇਲਾਕੇ ਨੂੰ ਦੇ ਥਾਣੇ ਨੂੰ ਭੇਜ ਦਿੰਦਾ ਥਾਣੇ ਤੋਂ ਫਿਰ ਕੋਈ ਮੁਲਾਜ਼ਮ ਆਉਂਦਾ ਵੈਰੀਫਾਈ ਕਰਦਾ ਹੈ ਸ ਭਾਵੇਂ ਸਰਪੰਚ ਤੋਂ ਕਰੇ ਭਾਵੇਂ ਦੋ ਗੁਆਂਢੀਆਂ ਤੋਂ ਕਰੇ ਭਾਵੇਂ ਲੰਬੜਦਾਰ ਤੋਂ ਕਰੇ ਉਹ ਤੋਂ ਬਾਅਦ ਫਿਰ ਦੁਬਾਰਾ ਪਾਸਪੋਰਟ ਆਪਣਾ ਬਣਾ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਜਿਵੇਂ ਆਪਾਂ ਕੋਈ ਬਰਥ ਸਰਟੀਫਿਕੇਟ ਬਣਾਉਣਾ ਹੈ ਉਹਦੇ ਵਿੱਚ ਸਾਨੂੰ ਪਹਿਲਾਂ ਹਸਪਤਾਲ ਤੋਂ ਲੈਣਾ ਪੈਂਦਾ ਉਹ ਤੋਂ ਬਾਅਦ ਫਿਰ ਇਲਾਕੇ ਦੇ ਵਿੱਚ ਡੀ ਸੀ ਦਫਤਰ ਦੇ ਵਿੱਚੋਂ ਐਪਲਾਈ ਕਰਨਾ ਪੈਂਦਾ ਉਤੋਂ ਬਣ ਤਾਂ ਸਾਰੇ ਕੰਮ ਜਾਂਦੇ ਮੁਸ਼ਕਿਲਾਂ ਤਾਂ ਆਉਂਦੀਆਂ ਥੋੜ੍ਹਾ ਘੁੰਮਣਾ ਤਾਂ ਪੈਂਦਾ ਪਰ ਬਣ ਸਭ ਕੁਝ ਜਾਂਦਾ